ਅਸੀਂ ਗੁਰਸਿੱਖ ਪਰਿਵਾਰ ਹਾਂ ਸਾਡੇ ਸਿੱਖ ਧਰਮ ਵਿੱਚ ਗੁਰਪੁਰਬ ਨੂੰ ਬਹੁਤ ਜ਼ਿਆਦਾ ਮਹਾਨਤਾ ਦਿੱਤੀ ਜਾਂਦੀ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਗਿਆ ਜਨਮ ਦਿਹਾੜਾ ਉਸ 'ਤੇ ਅਸੀਂ ਸਾਰੇ ਜਣੇ ਰਲ਼ ਕੇ ਕਈ ਦਿਨ ਪਹਿਲਾਂ ਤਿਆਰੀਆਂ ਕਰਦੇ ਗੁਰਦੁਆਰੇ ਦੀ ਸਾਫ ਸਫਾਈ ਕਰਦੇ ਹਾਂ ਅਤੇ ਫੇਰ ਉਸ ਦੇ ਵਿੱਚ ਜਿਸ ਦਿਨ ਗੁਰਪੁਰਬ ਹੁੰਦਾ ਉਸ ਦਿਨ ਸਾਰੇ ਜਣੇ ਰਲ਼ ਕੇ ਗੁਰਦੁਆਰੇ ਵਿੱਚ ਪਾਠ ਕਰਦੇ ਹੈ ਅਤੇ ਕੀਰਤਨ ਕਰਦੇ ਹੈ ਅਤੇ ਲੰਗਰ ਦੀ ਸੇਵਾ ਵੀ ਹੁੰਦੀ ਹੈ ਸਾਰੇ